ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਸ਼ਹਿਰ ਦੀ ਰਹਿਣ ਵਾਲੀ ਹਾਂ ਮੈਂ ਆਪਣੇ ਇਲਾਕੇ ਦੇ ਕਾਫੀ ਪਾਰਟੀਆਂ ਦੇ ਨੇਤਾਵਾਂ ਨੂੰ ਜਾਣਦੀ ਹਾਂ ਜਿਵੇਂ ਕਿ ਸਾਡੇ ਐੱਮ ਸੀ ਸਾਹਿਬ ਸਾਡੇ ਐੱਮ ਐੱਲ ਏ ਸਾਹਿਬ ਅਤੇ ਹੋਰ ਵਾਰਡਾਂ ਦੇ ਐੱਮ ਸੀ ਇਹਨਾਂ ਸਾਰਿਆਂ ਨੂੰ ਜਾਣਨ ਦੀ ਮੈਂ ਜਾਣਦੀ ਹਾਂ ਅਤੇ ਇਹ ਸਾਰੇ ਬਹੁਤ ਚੰਗੇ ਹਨ ਇਹ ਸਾਡੀ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਉਹਨਾਂ ਦਾ ਹੱਲ ਕੱਢਦੇ ਹਨ ਇਹ ਸਾਡੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਕਾਫੀ ਸਾਰੀ ਮਦਦ ਕਰਦੇ ਹਨ ਅਤੇ ਇਹ ਆਪਣੇ ਫਰਜ਼ ਦਾ ਬਿ ਪੂਰਾ ਪਾਲਣ ਕਰਦੇ ਹਨ ਇਹਨਾਂ ਨੇ ਸਾਡੇ ਹਰ ਨਾਗਰਿਕ ਦੀ ਬਹੁਤ ਮਦਦ ਕੀਤੀ ਹੈ ਜਿਹੜਾ ਨਾਗਰਿਕ ਇਹਨਾਂ ਦੇ ਕੋਲ ਪਰੇਸ਼ਾਨੀ ਲੈ ਕੇ ਜਾਂਦਾ ਹੈ ਇਹ ਹਰ ਨਾਗਰਿਕ ਦੀ ਪਰੇਸ਼ਾਨੀ ਦਾ ਪਰੇਸ਼ਾਨੀ ਸੁਣਦੇ ਹਨ ਅਤੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਹੱਲ ਕਰਨ ਲਈ ਹੱਲ ਕੱਢਦੇ ਹਨ ਅਤੇ ਇਹ ਹਰ ਇੱਕ ਦਾ ਕੰਮ ਸਾਫ ਕਰਦੇ ਹਨ ਧੰਨਵਾਦ